ਸਾਡੇ ਖੇਤਰ ਵਿੱਚ ਸਰਕਾਰ ਖਿਡਾਰੀਆਂ ਦੁਆਰਾ ਬਹੁਤ ਵਧੀਆ ਕੰਮ ਕਰ ਰਹੀ ਹੈ ਜਿੱਥੇ ਤੱਕ ਦੇਖਿਆ ਜਾਵੇ ਇਨ੍ਹਾਂ ਨੂੰ ਵਧੀਆ ਖੁਰਾ ਖੁਰਾਕ ਮਿਲ ਰਹੀ ਹੈ ਸਪੋਰਟਸਮੈਨ ਮਿਲ ਰਹੇ ਹਨ ਅਤੇ ਖੇਡਣ ਦਾ ਸਾਰਾ ਸਮਾਨ ਮਿਲਦਾ ਹੈ ਮਿਲ ਰਿਹਾ ਹੈਗਾ ਜਿਸ ਕਰਕੇ ਖਿਡਾਰੀਆਂ ਨੂੰ ਕੋਈ ਵੀ ਦਿੱਕਤ ਨਹੀਂ ਆ ਰਹੀ ਹੈਗੀ